ਹੈਲੋ ਹਾਂਜੀ ਜੀ ਹਾਂਜੀ ਹੋਰ ਸੁਣਾਓ ਹਾਂਜੀ ਦੀਦੀ ਸੁਆ ਸਕਦੇ ਹੋ ਤੁਸੀਂ ਹਾਂਜੀ ਦੀਦੀ ਤੁਸੀਂ ਦੇ ਦੋ ਆਪਣਾ ਸੂਟ ਹਾਂਜੀ ਤੁਸੀਂ ਆਪਣਾ ਨਾਪ ਲਿਖਾ ਦਿਓ ਹਾਂਜੀ ਹਾਂਜੀ ਹਾਂਜੀ ਹਾਂਜੀ ਹਮ ਹਾਂਜੀ ਹਾਂਜੀ ਵਾਜੂ ਠੀਕ ਹੈ ਜੀ ਠੀਕ ਹੈ ਦੀਦੀ ਕੋਈ ਨਹੀਂ ਮੈਂ ਵਧੀਆ ਰੱਖ ਕੇ ਸੀਵਾਂਗੀ ਅਤੇ ਹੋ ਸਕੇ ਤਾਂ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਕਸਟਮਰ ਤੁਸੀਂ ਭੇਜ ਸਕਦੇ ਹੋ ਅਤੇ ਮੇਰੇ ਵੱਲੋਂ ਕੋਈ ਕਮੀ ਨਹੀਂ ਆਏਗੀ ਸੂ ਸੂਟ ਸਿਉਣ 'ਚ

ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਦੀਦੀ ਤੁਸੀਂ ਭੇਜ ਦੀਓ ਮੈਂ ਸਿਓ ਦਾਂਗੀ ਹੋਰ ਬਸ ਜੀ ਜ਼ਿਆਦਾ ਤੋਂ ਜ਼ਿਆਦਾ ਕਸਟਮਰ ਭੇਜਿਓ ਹਾਂਜੀ ਠੀਕ ਓਕੇ